ਹਾਂਜੀ ਸਾਡੇ ਕੋਲੇਜ ਵਿੱਚ ਲਾਈਬ੍ਰੇਰੀ ਹੈ ਅਤੇ ਮੈਨੂੰ ਕਿਤਾਬਾਂ ਪੜ੍ਹਨੀਆਂ ਸ਼ੁਰੂ ਤੋਂ ਹੀ ਬਹੁਤ ਪਸੰਦ ਹਨ ਮੈਂ ਬਚਪਨ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਕੁਝ ਕਿਤਾਬਾਂ ਮੈਂ ਹਿੰਦੀ ਵੀ ਪੜ੍ਹੀਆਂ ਹਨ ਪੰਜਾਬੀ ਭਾਸ਼ਾ ਵਿੱਚ ਵੀ ਪੜ੍ਹੀਆਂ ਹਨ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਪੜ੍ਹੀਆਂ ਹਨ ਜੋ ਮੈਂ ਕਿਤਾਬਾਂ ਹਿੰਦੀ ਭਾਸ਼ਾ ਵਿੱਚ ਪੜ੍ਹੀਆਂ ਹਨ ਇੱਕ ਮੈਂ ਪੜ੍ਹੀ ਹੈ ਅਨੋਖੇ ਉਪਹਾਰ ਅਤੇ ਇੱਕ ਦਾ ਨਾਮ ਹੈ ਬੇਟੀ ਕਰੇ ਸਵਾਲ ਅੰਗਰੇਜ਼ੀ ਵਿੱਚ ਜੋ ਮੈਂ ਪੜ੍ਹੀਆਂ ਹਨ ਉਹ ਹਨ ਨਾਵਲਾਂ ਅਤੇ ਅੱਜ ਕੱਲ੍ਹ ਮੈਨੂੰ ਲੱਗਦਾ ਸਭ ਨੇ ਹੀ ਉਹ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਤੇ ਆਪਣੇ ਬਚਪਨ ਵਿੱਚ ਵੀ ਪੜ੍ਹੀਆਂ ਹੋਣਗੀਆਂ ਜਿਨ੍ਹਾਂ ਦਾ ਨਾਮ ਹੈ ਅੰਗਰੇਜ਼ੀ ਦੀ ਇੱਕ ਨਾਵਲ ਸੀ ਸਿੰਡਰੇਲਾ ਅਤੇ ਇੱਕ ਸੀ ਦਾ ਅਗਲੀ ਡੱਕ ਇਹ ਨਾਵਲਾਂ ਵਿੱਚ ਬੜੀਆਂ ਵਧੀਆ ਕਹਾਣੀਆਂ ਪਿਰੋਈਆਂ ਹੁੰਦੀਆਂ ਹਨ ਇਹਨਾਂ ਦੇ ਸ਼ਬਦ ਬੜੇ ਹੀ ਆਸਾਨ ਸੀ ਅਤੇ ਬਚਪਨ ਵਿੱਚ ਕੁਝ ਮੈਂ ਇੱਦਾਂ ਦੀਆਂ ਹੀ ਕਿਤਾਬਾਂ ਪੜ੍ਹੀਆਂ ਸਨ ਪਰੰਤੂ ਮੈਨੂੰ ਕਿਤਾਬਾਂ ਪੜ੍ਹਨ ਦਾ ਹੁਣ ਤੱਕ ਵੀ ਬਹੁਤ ਸ਼ੌਕ ਹੈ ਮੈਨੂੰ ਨਾਵਲਾਂ ਪੜ੍ਹਨੀਆਂ ਜ਼ਿਆਦਾ ਵਧੀਆ ਲੱਗਦੀਆਂ ਹਨ ਕਿਉਂਕਿ ਨਾਵਲਾਂ ਵਿੱਚ ਇੱਕ ਕਹਾਣੀ ਚੱਲਦੀ ਹੈ ਅਤੇ ਮੈਂ ਕੁਝ ਇਦਾਂ ਦੀਆਂ ਕਿਤਾਬਾਂ ਵੀ ਪੜ੍ਹਦੀ ਹਾਂ ਜਿਨ੍ਹਾਂ ਵਿੱਚ ਸਾਨੂੰ ਪ੍ਰੇਰਿਤ ਕੀਤਾ ਜਾਵੇ ਜਾਂ ਸਾਨੂੰ ਸਮੇਂ ਦੀ ਬੱਚਤ ਕਰਨੀ ਸਿਖਾਈ ਜਾਵੇ ਜਾਂ ਸਾ ਮੈਂ ਇੱਦਾਂ ਦੀਆਂ ਕਿਤਾਬਾਂ ਪੜ੍ਹਨੀਆਂ 'ਚ ਵੀ ਦਿਲਜਸਪੀ ਰੱਖਦੀ ਹਾਂ ਜਿਨ੍ਹਾਂ ਵਿੱਚ ਕੁੜੀਆਂ ਦੀਆਂ ਜ਼ਿੰਦਗੀ ਬਾਰੇ ਦੱਸਿਆ ਜਾਵੇ ਧੰਨਵਾਦ